ਮੈਂ ਹਮੇਸ਼ਾ ਭੋਜਨ ਸਮੇਂ ਮੈਨੂੰ ਜਿਹੜੀ ਚੀਜ਼ਾਂ ਤੋਂ ਐਲਰਜੀ ਹੈ ਮੈਂ ਖ਼ਾਸ ਕਰਕੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੰਦੀ ਹਾਂ ਖ਼ਾਸ ਕਰਕੇ ਜਦੋਂ ਮੈਂ ਅਰਬੀ ਜਾਂ ਬੈਂਗਣ ਬਨ ਜਿਨ੍ਹਾਂ ਤੋਂ ਮੈਨੂੰ ਬਹੁਤ ਐਲਰਜੀ ਆ ਉਹਨਾਂ ਨੂੰ ਬਕਾ ਬਣਾਉਣ ਸਮੇਂ ਬਹੁਤ ਧਿਆਨ ਨਾਲ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਰੱਖਦੀ ਹਾਂ ਜਿਵੇਂ ਕਿ ਘੱਟ ਨਮਕ ਖਾਣਾ ਚਾਹੀਦਾ ਹੈ ਘੱਟ ਮਿਰਚ ਖਾਣੀ ਚਾਹੀਦੀ ਹੈ ਜੋ ਕਿ ਸਿਹਤ ਲਈ ਨੁਕਸਾਨ ਹੈ ਤੇਲ ਵੀ ਸਾਨੂੰ ਸੀਮਿਤ ਮਾਤਰਾ 'ਚ ਪਾਉਣਾ ਚਾਹੀਦਾ ਨਾ ਕਿ ਬਹੁਤ ਜ਼ਿਆਦਾ ਪਾਉਣਾ ਚਾਹੀਦਾ ਕਿਉਂਕਿ ਜ਼ਿਆਦਾ ਤੇਲ ਵੀ ਸਾਡੇ ਲਈ ਬਹੁਤ ਹਾਨੀਕਾਰਕ ਹੈ ਮਸਾਲਿਆਂ ਦੀ ਸਾਨੂੰ ਜ਼ਿਆਦਾ ਵਰ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਸਾਨੂੰ ਸਾਫ਼ ਸੁਥਰਾ ਅਤੇ ਸਾਦਾ ਭੋਜਨ ਖਾਣਾ ਚਾਹੀਦਾ ਜੋ ਕਿ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਸਾਨੂੰ ਜਿਵੇਂ ਕਿ ਰਾਜਮਾਂਹ ਚੋਲ ਆਦਿ ਦਾ ਵੀ ਪ੍ਰਹੇਜ਼ ਰੱਖਣਾ ਚਾਹੀਦਾ ਜਿਨ੍ਹਾਂ ਨੂੰ ਤਾਂ ਸ਼ੂਗਰ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ ਖੀਰ ਪੂੜੇ ਆਦਿ ਆਦਿ ਵਰ ਅ ਚੀਜ਼ਾਂ ਦੀ ਵਰਤੋਂ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਸੇਵਨ ਕਰਦੇ ਹਾਂ ਤਾਂ ਆਪਣੇ ਸਰੀਰ ਨੂੰ ਖੁਦ ਹੀ ਨੁਕਸਾਨ ਪਹੁੰਚਾਉਂਦੇ ਹਾਂ ਅੱਗੇ ਜਾ ਕੇ ਸਾਡਾ ਸਰੀਰ ਹੋਰ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਇਸ ਕਰਕੇ ਸਾਨੂੰ ਆਪਣੀਆਂ ਬਿਮਾਰੀਆਂ ਤੋਂ ਬਚਣ ਲਈ ਪਹਿਲੇ ਸਾਨੂੰ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਸਾਨੂੰ ਕਣਕ ਦਾ ਆਟਾ ਨਹੀਂ ਇਸਤੇਮਾਲ ਕਰਨਾ ਚਾਹੀਦਾ ਸਗੋਂ ਮੱਕੀ ਦਾ ਆਟਾ ਰਵਾ ਆਦਿ ਮਿਕਸ ਆਟਾ ਯੂਜ਼ ਕਰਨਾ ਚਾਹੀਦਾ ਹੈ ਸਿੰਘਾੜੇ ਦੇ ਆਟੇ ਦੀ ਰੋਟੀ ਪਕਾਉਣੀ ਚਾਹੀਦੀ ਹੈ ਮੂਲੀ ਇਡਲੀ ਸਬਜ਼ੀਆਂ ਪਾ ਕੇ ਪੁਲਾਓ ਬਣਾਉਣੇ ਚਾਹੀਦੇ ਹਨ ਜੋ ਕਿ ਸਾਡੇ ਸਿਹਤ ਲਈ ਬਹੁਤ ਵਧੀਆ ਹਨ ਜਿਨ੍ਹਾਂ ਤੋਂ ਨਾ ਤਾਂ ਸਾਨੂੰ ਕਦੀ ਨੁਕਸਾਨ ਮਿਲਦਾ ਹੈ ਜੋ ਸਾਡੇ ਸਿਹਤ ਲਈ ਵੀ ਵਧੀਆ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ ਸਾਨੂੰ ਉਬਲੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਸਾਨੂੰ ਪੁਲਾਓ ਆਦਿ ਵੀ ਬਣਾਉਣੇ ਚਾਹੀਦੇ ਹਨ ਆਲੂ ਗੋਭੀ ਮੂਲੀ ਦਾ ਪਰੌਂਠਾ ਜੋ ਕਿ ਸਾਡੇ ਲਈ ਬਹੁਤ ਵਧੀਆ ਹੈ ਅਤੇ ਸ਼ੂਗਰ ਲਈ ਵੀ ਸਾਡੇ ਸਹਾਇਕਮੰਦ ਹੈ ਇਸ ਕਰਕੇ ਸਾਨੂੰ ਬਿਮਾਰੀਆਂ ਤੋਂ ਬਚਣ ਤੋਂ ਪਹਿਲਾਂ ਸਾਨੂੰ ਆਪਣੇ ਖ਼ੁਰਾਕ ਅਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ